ਹੈਲੋ ਸਤਿ ਸ਼੍ਰੀ ਅਕਾਲ ਜੀ ਬਿਲਕੁਲ ਜੀ ਬਹੁਤ ਵਧੀਆ ਤੁਸੀਂ ਸੁਣਾਓ ਹਾਂਜੀ ਹਾਂਜੀ ਹਾਂਜੀ ਟਰੈਡੀਸ਼ਨਲ ਸਟੋਰ ਤੋਂ ਬੋਲਦੇ ਪਏ ਹਾਂਜੀ ਹਾਂਜੀ ਹਾਂਜੀ ਦੱਸੋ ਕਿੱਦਾਂ ਦੇ ਕੱਪੜੇ ਚਾਹੀਦੇ ਆ ਸਾਡੇ ਕੋਲ ਸਾਰੇ ਕੱਪੜੇ ਅਵੇਲੇਬਲ ਹੈ ਹਾਂਜੀ ਹਾਂਜੀ ਸਾਡੇ ਕੋਲ ਸਲਵਾਰ ਸੂਟ ਵੀ ਅਵੇਲੇਬਲ ਹੈਗੇ ਆ ਸਾਡੇ ਕੋਲ ਘੱਗਰੇ ਔਰ ਕੁੜਤੀਆਂ ਵੀ ਅਵੇਲੇਬਲ ਹਨ ਨਾਲ ਪਰਾਂਦੀਆਂ ਨਾਲ ਟਿੱਕੇ ਸਭ ਕੁਝ ਅਵੇਲੇਬਲ ਹੈ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਡਮ ਗੋਲਡਨ ਲੈਸ ਵਾਲੇ ਸਾਡੇ ਕੋਲ ਚੁੰਨੀਆਂ ਓਹੀ ਲੈਸ ਚੁੰਨੀ ਨੂੰ ਲੱਗੀ ਹੋਈ ਹੈ ਅਤੇ ਓਹੀ ਘੱਗਰੇ ਨੂੰ ਲੱਗੀ ਹੋਈ ਹੈ ਅਤੇ ਉਹ ਲੈਸਾਂ ਸਾਡੇ ਕੋਲ ਗੋਲਡਨ ਲੈਸਾਂ ਵਾਲੇ ਜਿਹੜੀਆਂ ਹੈਗੇ ਉਪਲਬਧ ਨੇ

ਹਾਂਜੀ ਹਾਂਜੀ ਹਾਂਜੀ ਹਾਂਜੀ ਟਰੈਡੀਸ਼ਨਲ ਜਿਹੜੇ ਕੱਪੜੇ ਹਾਂਜੀ ਹਾਂਜੀ ਸਾਡੇ ਕੋਲ ਬੱਚਿਆਂ ਦੇ ਕੱਪੜੇ ਵੀ ਹੈਗੇ ਹੈ ਬੱਚਿਆਂ ਵਾਸਤੇ ਵੀ ਸਾਡੇ ਕੋਲ ਪੂਰੇ ਸੈੱਟ ਹੁੰਦੇ ਆ ਨਾਲ ਪਰਾਂਦੀ ਨਾਲ ਟਿੱਕਾ ਸੈਟ ਨਾਲ ਉਹਨਾਂ ਦੇ ਛੋਟੇ ਘੱਗਰੇ ਅਤੇ ਨਾਲ ਉਹਨਾਂ ਦੀਆਂ ਛੋਟੀਆਂ ਛੋਟੀਆਂ ਕੁੜਤੀਆਂ ਉਹਨਾਂ ਦੇ ਹਿਸਾਬ ਦੀਆਂ ਸਾਡੇ ਕੋਲ ਉਹ ਵੀ ਹਨ ਹਾਂਜੀ ਹਾਂਜੀ ਹਾਂਜੀ ਹਾਂਜੀ ਉਹ ਵੀ ਸ਼ੇਰਵਨ ਹਾਂਜੀ ਹਾਂਜੀ ਹਾਂਜੀ ਸ਼ੇਰਵਾਨੀਆਂ ਵੀ ਸਾਡੇ ਕੋਲ ਹੈਗੀਆਂ ਆ ਸਾਡੇ ਕੋਲ ਕੁੜਤੇ ਚਾਦਰੇ ਵੀ ਹੈਗੇ ਆ ਤੁਰਲੇ ਛੱਡ ਕੇ ਜਿਹੜੀ ਪੱਗ ਹੈ ਉਹ ਵੀ ਬਣੀ ਬਣਾਈ ਹੈ ਸਾਡੇ ਕੋਲ ਆਉਂਦੀ ਹੈ ਸਾਡੇ ਕੋਲ ਉਹ ਵੀ ਸਾਰਾ ਸਮਾਨ

ਹਾਂਜੀ ਹਾਂਜੀ ਹਾਂਜੀ ਤੁਸੀਂ ਹਾਂਜੀ ਰਾਤ ਦੇ ਦਸ ਵਜੇ ਤੱਕ ਸਾਡਾ ਸਟੋਰ ਖੁੱਲਾ ਹੁੰਦਾ ਸਵੇਰ ਦੇ ਨੌ ਵਜੇ ਤੋਂ ਲੈ ਕੇ ਰਾਤ ਦਸ ਵਜੇ ਤੱਕ ਤੁਸੀਂ ਕਦੋਂ ਵੀ ਆ ਕੇ ਦੇਖ ਸਕਦੇ ਹੈ

ਸਤਿ ਸ਼੍ਰੀ ਅਕਾਲ